ਹੈਲੋ ਹਾਂਜੀ ਹਾਂਜੀ ਫਾਜ਼ਿਲਕਾ ਡਿਸਟਰਿਕਟ ਦੇ ਵਿੱਚ ਫ਼ਿਲਹਾਲ ਕਾਫੀ ਇਹਨੂੰ ਡਿਸਟਰਿਕ ਬਣਨ ਤੋਂ ਬਾਅਦ ਇਹਦੇ ਚ ਕਾਫੀ ਡਿਵੈਲਪਮੈਂਟ ਹੋਈਆਂ ਨੇ ਜਾਂ ਚੱਲ ਰਹੀਆਂ ਨੇ ਜਿਵੇਂ ਕਿ ਜਿਹੜਾ ਪੁਰਾਣੇ ਬਸ ਸਟੈਂਡ ਤੋਂ ਨਵੇਂ ਬਸ ਸਟੈਂਡ ਬਣ ਗਿਆ ਐਂਡ ਜਿਹੜੇ ਘੰਟਾ ਘਰ ਵਾਲੀ ਰੋਡ ਹੈ ਇਹ ਵੀ ਸਾਰੀ ਅੱਛੀ ਰੋਡ ਬਣ ਰਹੀ ਹੈ ਕਿਉਂਕਿ ਇੱਥੇ ਸਾਰੀ ਮੇਨ ਮਾਰਕੀਟ ਹੈ ਆ ਰੇਲਵੇ ਸਟੇਸ਼ਨ ਕਾਫੀ ਅੱਛਾ ਬਣ ਗਿਆ ਉੱਥੇ ਕਾਫੀ ਅੱਛੀ ਹੁਣ ਗਰੀਨਰੀ ਵੀ ਹੋ ਗਈ ਹੈ ਗਰੀਨਰੀ ਲਾ ਦਿੱਤੀ ਹੈ ਸਾਰੀ ਪੇਡ ਲਗਾ ਦਿੱਤੇ ਹੈ ਤਾਂ ਉਹ ਵਿਊ ਬਹੁਤ ਅੱਛਾ ਲੱਗਦਾ ਲੋਕਾਂ ਲਈ ਵੀ ਅਗਰ ਵੇਟ ਕਰਨਾ ਤਾਂ ਬੈਠਣਾ ਵੇਟ ਕਰਨ ਲਈ ਬੈਠਣ ਲਈ ਥੋੜ੍ਹਾ ਈਜ਼ੀ ਹੋ ਗਿਆ ਐਂਡ ਫਲਾਈ ਓਵਰ ਬਣ ਗਏ ਨੇ ਅੰਡਰਵਿਜ ਬਣ ਗਿਆ ਜੋ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਸੀਗੀ ਕਿ ਰੇਲਵੇ ਲਾਈਨ ਤੋਂ ਇੰਨਾ ਇੰਨਾ ਟਾਈਮ ਫਾਟਕ 'ਤੇ ਖੜ੍ਹੇ ਰਹਿਣਾ ਵੇਟ ਕਰਨਾ ਔਰ ਐਕਸੀਡੈਂਟ ਦੇ ਚਾਂਸਸ ਵੀ ਹੁੰਦੇ ਆ ਕਿਉਂਕਿ ਲੋਕ ਫਾਟਕ ਦੇ ਨੀਚੋਂ ਦੀ ਬਹੁਤ ਟੂ ਵਿਲਰਸ ਵਾਲੇ ਲੰਘ ਕੇ ਜਾਂਦੇ ਸੀ ਐਂਡ ਬਹੁਤ ਲੋਕਾਂ ਨੂੰ ਦਿੱਕਤ ਹੁੰਦੀ ਸੀ ਤਾਂ ਅੰਡਰਬ੍ਰਿਜ ਦੇ ਬਣਨ ਨਾਲ ਬਹੁਤ ਫਾਇਦਾ ਹੋਇਆ ਐਂਡ ਜਿਹੜੀਆਂ ਰੋਡਸ ਨੇ ਉਹ ਵੱਡੀਆਂ ਹੋ ਰਹੀਆਂ ਨੇ ਕਾਫੀ ਬਰੋਡ ਕੀਤੀਆਂ ਜਾ ਰਹੀਆਂ ਨੇ ਜੋ ਏਟ ਏਟ ਏਟ ਲੇਨ ਨਿਕਲ ਰਿਹਾ ਭਾਰਤ ਮਾਲਾ ਵਾਲਾ ਉਹ ਵੀ ਫਾਜ਼ਿਲਕਾ ਡਿਸਟਰਿਕਟ ਦੇ ਵਿੱਚੋਂ ਨਿਕਲ ਰਿਹਾ ਜਿਹਦਾ ਜਿਹਦੇ ਨਾਲ ਕੀ ਹੈ ਬਹੁਤ ਬਾਈਪਾਸ ਨਾਲ ਆਪਸ 'ਚ ਕਨੈਕਟ ਹੋਣਗੇ ਜਿਹਦੇ ਕਰਕੇ ਲੋਕਾਂ ਨੂੰ ਜਿਹੜਾ ਸਫਰ ਹੈ ਬਹੁਤ ਜਲਦੀ ਕਵਰ ਹੋ ਜਾਇਆ ਕਰੇਗਾ ਹਾਂਜੀ ਹਾਂ ਕੁਛ ਜਿਵੇਂ ਕਹਿ ਲਓ ਇਮਪਰੂਵਮੈਂਟ ਐਵੇਂ ਹੈ ਬਈ ਜਿਹੜੇ ਰੋਡਸ ਹੈ ਜਿੱਥੇ ਬੈਚ ਵਰਕ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਉਹ ਰੋਡਸ ਨੂੰ ਥੋੜ੍ਹਾ ਜਿਹਾ ਹੋਰ ਵਧੀਆ ਇੰਪਰੂਵ ਕਰਨਾ ਚਾਹੀਦਾ ਪੈਚ ਵਰਕ ਦੀ ਬਜਾਇ ਐਂਡ ਜੋ ਇੰਨਾਂ ਰੋਡਸ ਨੇ ਉਹ ਥੋੜ੍ਹੀਆਂ ਬਰੋਡ ਕਰ ਦਿੱਤੀਆਂ ਜਾਣ ਤਾਂ ਕੀ ਲੋਕਾਂ ਦੀ ਕਰੋਸਿੰਗ ਕਰਨੀ ਲੈਫਟ ਰਾਈਟ ਲਈ ਈਜ਼ੀ ਹੋ ਜੇ ਹੋ ਜਾਏ ਔਰ ਥੋੜ੍ਹੀਆਂ ਰੋਡ ਜਿਹੜੀਆਂ ਬਰੋਡ ਕਰ ਦਿੱਤੀਆਂ ਜਾਣ ਸੀਵਰੇਜ ਸਿਸਟਮ ਜਿਹੜਾ ਥੋੜ੍ਹਾ ਇਮਪਰੂਵ ਕਰਨਾ ਚਾਹੀਦਾ ਸੀਵਰੇਜ ਦੇ ਸਿਸਟਮ ਨੂੰ ਹੋਰ ਇੰਮਪਰੂਵ ਫਿਲਹਾਲ ਦੀ ਘੜੀ ਸੀਵਰੇਜ ਸਿਸਟਮ ਇੰਮਪਰੂਵ ਹੋ ਰਿਹਾ ਬਟ ਮੈਨੂੰ ਲੱਗਦਾ ਇਹਦੇ 'ਤੇ ਹੋਰ ਫੋਕਸ ਕੀਤਾ ਜਾਣਾ ਚਾਹੀਦਾ ਐਂਡ ਜਿਹੜੀਆਂ ਕਲੋਨੀਜ ਬਣ ਗਈਆਂ ਕਿ ਕਲੋਨੀਜ ਸਾਰੇ ਸ਼ਹਿਰ ਦੇ ਨੇੜੇ ਨੇੜੇ ਕਲੋਨੀਜ ਬਣੀਆਂ ਔਰ ਉਹ ਕਲੋਨੀ ਦੇ ਆਪਣੇ ਗੇਟ ਨੇ ਔਰ ਅੰਦਰ ਜਿਹੜੀ ਸਫ਼ਾਈ ਆ ਬਹੁਤ ਜ਼ਿਆਦਾ ਔਰ ਜਿਹੜੇ ਉਹਨਾਂ ਦੀਆਂ ਰੋਡਸ ਹੈ ਉੱਥੇ ਫਿਰ ਚੋਰੀ ਡਕੈਤੀ ਦਾ ਵੀ ਡਰ ਬਹੁਤ ਘੱਟ ਹੈ ਤਾਂ ਉਹ ਵੀ ਇੱਕ ਡਿਵੈਲਪਮੈਂਟ ਦਾ ਹੀ ਹਿੱਸਾ ਕਹਿ ਸਕਦੇ ਆ ਆਪਾਂ ਐਂਡ ਇਸ ਡਿਵੈਲਪਮੈਂਟ ਕਰਕੇ ਜਿਹੜੇ ਜਿਵੇਂ ਫਾਜ਼ਿਲਕਾ ਤੋਂ ਅਬੋਹਰ ਰੋਡ ਆ ਹੁਣ ਇਸ ਰੋਡ ਨੂੰ ਇੰਨਾ ਅੱਛਾ ਡਿਵੈਲਪ ਕਰਤਾ ਔਰ ਸਾਰਾ ਸ਼ਹਿਰ ਜਿਹੜਾ ਹੈ ਫਾਜਲਕਾ ਅਬੋਹਰ ਰੋਡ 'ਤੇ ਨਿਕਲ ਰਿਹਾ ਔਰ ਜੋ ਲੋਕ ਅੰਦਰ ਬਹੁਤ ਕੰਜਸਟਡ ਸੀ ਸਾਰਾ ਸ਼ਹਿਰ ਦੇ ਅੰਦਰ ਅੰਦਰ ਬਹੁਤ ਕੰਜਸਟਡ ਸੀ ਹੁਣ ਉਸ ਰੋਡ 'ਤੇ ਸ਼ੋਰੂਮਸ ਬਣਦੇ ਨੇ ਜੋ ਸ਼ਹਿਰ ਦੇ ਵਿੱਚ ਨਹੀਂ ਬਣ ਸਕਦੇ ਸੀ ਜੋ ਚੀਜ਼ਾਂ ਪੋਸੀਬਲ ਨਹੀਂ ਸੀ ਉਹ ਹੁਣ ਸ਼ਹਿਰ ਦੇ ਬਾਹਰ ਪੋਸੀਬਲ ਹੋ ਗਈਆਂ ਔਰ ਇਸ ਕਰਕੇ ਲੋਕਾਂ ਦਾ ਜਿਹੜਾ ਕਿ ਜੇ ਸ਼ਹਿਰ ਦਾ ਡਿਵੈਲਪਮੈਂਟ ਹੋਈ ਹੈ ਤਾਂ ਲੋਕਾਂ ਦਾ ਵੀ ਵਿਕਾਸ ਹੋ ਰਿਹਾ ਠੀਕ ਹੈ ਠੀਕ ਧੰਨਵਾਦ ਜੀ ਤੁਹਾਡਾ